ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਭਾਰਤ ਦੀ ਅਰਥ ਵਿਵਸਥਾ ਬਾਰੇ ਪੰਜਾਬ ਦਾ ਕੀ ਰੋਲ ਆ ਤੁਹਾਨੂੰ ਮੈਂ ਕਿਹਾ ਸੀਗਾ ਤੁਸੀਂ ਕਹਿੰਦੇ ਮੈਂ ਦੱਸਾਂਗੀ ਦੱਸੋ

ਠੀਕ ਹੈ ਜਦੋਂ ਹਾਂਜੀ ਤੁਸੀਂ ਥੋੜ੍ਹਾ ਹੋਰ ਮਟੀਰੀਅਲ ਇਕੱਠਾ ਕਰਕੇ ਫਿਰ ਮੈਨੂੰ ਦੱਸਿਓ ਠੀਕ ਏ ਜੀ ਓਕੇ ਓਕੇ ਓ